ਮੇਰਾ ਵਿਸ਼ੇਸ ਹੁਨਰ ਡਰਾਇੰਗ ਅਤੇ ਪੇਂਟਿੰਗ ਹੈ ਮੈਨੂੰ ਡਰਾਇੰਗ ਅਤੇ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਮੈਂ ਛੋਟੀ ਹੁੰਦੀ ਤੋਂ ਹੀ ਡਰਾਇੰਗ ਅਤੇ ਪੇਂਟਿੰਗ ਕਰਦੀ ਰਹੀ ਹਾਂ ਜਦੋਂ ਵੀ ਮੈਨੂੰ ਫਰੀ ਟਾਇਮ ਮਿਲਦਾ ਜਾਂ ਕੋਈ ਵੀ ਸਮਾਂ ਮਿਲਦਾ ਮੈਂ ਡਰਾਇੰਗ ਅਤੇ ਪੇਂਟਿੰਗ ਕਰਨਾ ਹੀ ਪਸੰਦ ਕਰਦੀ ਹਾਂ ਮੈਂ ਡਰਾਇੰਗ ਅਤੇ ਪੇਂਟਿੰਗ ਕਿਸੇ ਵੀ ਕੋਲੋਂ ਸਿੱਖੀ ਨਹੀਂ ਹੈ ਇਹ ਮੇਰੇ ਵਿੱਚ ਆਪਣੇ ਆਪ ਹੀ ਖੁੱਦ ਹੀ ਪੈਦਾ ਹੋਈ ਹੈ ਜਦੋਂ ਵੀ ਮੈਂ ਡਰਾਇੰਗ ਅਤੇ ਪੇਂਟਿੰਗ ਕਰਦੀ ਹਾਂ ਤਾਂ ਮੇਰੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਅਤੇ ਏ ਜਦੋਂ ਹੌਲੀ ਹੌਲੀ ਮੈਂ ਪੇਟਿੰਗ ਦਿਨ ਪਰ ਦਿਨ ਕਰਦੀ ਗਈ ਤਾਂ ਹੌਲੀ ਹੌਲੀ ਮੇਰੀ ਪੇਂਟਿੰਗ ਹੋਰ ਵਧੀਆ ਤੋਂ ਵਧੀਆ ਬਣਦੀ ਗਈ ਅਤੇ ਡਰਾਇੰਗ ਵਿੱਚ ਵੀ ਸੁਧਾਰ ਆਉਂਦਾ ਗਿਆ ਜਿਸ ਨਾਲ ਕਿ ਆ ਮੇਰਾ ਪੇਟਿੰਗ ਅਤੇ ਡਰਾਇੰਗ ਦਾ ਇੱਕ ਹੁਨਰ ਬਣ ਗਿਆ ਅਤੇ ਘਰਦਿਆਂ ਨੇ ਵੀ ਮੇਰੇ ਇਸ ਹੁਨਰ ਦੀ ਬਹੁਤ ਤਾਰੀਫ਼ ਕੀਤੀ ਹੈ